ਹੈਲੋ ਹਾਂਜੀ ਕੀ ਹਾਲ ਚਾਲ ਕੀ ਹੋ ਰਹੇ ਨੇ ਵਧੀਆ ਵਧੀਆ ਬਸ ਕੋਲੇਜ ਹੀ ਬੈਠੀ ਸੀ ਥੋੜ੍ਹਾ ਬਹੁਤਾ ਦੇਖ ਰਹੀ ਸੀ ਡਾਟਾ ਵਗੈਰਾ ਬੱਚਿਆਂ ਦਾ ਮੈਂ ਜਿੱਥੋਂ ਤੱਕ ਮੈਨੂੰ ਲੱਗਦਾ ਅੱਜ ਕੱਲ੍ਹ ਬੱਚਿਆਂ ਦਾ ਧਿਆਨ ਜਿਹੜਾ ਹੈ ਉਹ ਆਈ ਟੀ ਵੱਲ ਜ਼ਿਆਦਾ ਕਿਉਂਕਿ ਦੇਖੋ ਸਭ ਕੁਝ ਹੀ ਡਿਜ਼ੀਟਲ ਹੁੰਦਾ ਜਾ ਰਿਹਾ ਅੱਜ ਤੋਂ ਦਸ ਸਾਲਾਂ ਬਾਅਦ ਏ ਆਈ ਆ ਜਾਵੇਗਾ ਪੂਰਾ ਕੁਛ ਅਤੇ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਸਾਡੇ ਸਟੂਡੈਂਟਸ ਇੰਨੇ ਅਵੇਅਰ ਨਹੀਂ ਹੈਗੇ ਤਾਂ ਉਹਨਾਂ ਨੂੰ ਇੰਨੀ ਫੈਸਿਲਿਟੀਜ਼ ਨਹੀਂ ਮਿਲੀਆਂ ਇਸ ਚੀਜ਼ 'ਚ ਅਤੇ ਸਾਨੂੰ ਇਹ 'ਤੇ ਕੰਮ ਕਰਨਾ ਚਾਹੀਦਾ ਤਾਂ ਕਿ ਸਾਡੇ ਸਟੂਡੈਂਟਸ ਵੀ ਜੋਬ ਰੈਡੀ ਹੋ ਜਾਣ ਅਤੇ ਜਿਹੜੀ ਕੱਲ੍ਹ ਨੂੰ ਮਾਰਕੀਟ ਆਉਣੀ ਹੈ ਉਹ 'ਚ ਕੰਮ ਕਰਨ ਦੇ ਲਾਇਕ ਹੋ ਜਾਣ ਉਹਨਾਂ 'ਚ ਉਹ ਸਕਿੱਲਸ ਆ ਜਾਣ ਤੁਹਾਨੂੰ ਕੀ ਲੱਗਦਾ ਇਸ ਬਾਰੇ ਬਿਲਕੁਲ ਅਤੇ ਮੈਂ ਸੋਚ ਰਹੀ ਸੀ ਕਿ ਅਸੀਂ ਨਾ ਇੱਕ ਪ੍ਰੋਜੈਕਟ ਬਣਾਉਂਦੇ ਹਾਂ ਇਸ ਬਾਰੇ ਅਤੇ ਅਸੀਂ ਉਹ 'ਤੇ ਕੰਮ ਕਰਦੇ ਹਾਂ ਅਤੇ ਬਾਅਦ 'ਚ ਅਸੀਂ ਫਿਰ ਸਟੂਡੈਂਟਸ ਨੂੰ ਪ੍ਰਜੈਂਟੇਸ਼ਨ ਦਿਖਾਵਾਂਗੇ ਠੀਕ ਹੈ ਠੀਕ ਹੈ ਚਲੋ ਠੀਕ ਹੈ ਠੀਕ ਹੈ ਮਿਲਦੇ ਹਾਂ ਸ਼ਾਮੀ ਫੇਰ ਓਕੇ